ਸਾਨੂੰ ਸਵੇਰੇ ਸਵੇਰੇ ਸਾਢ਼ੇ ਸੱਤ ਵਜੇ ਪਾਣੀ ਦੀ ਟੂਟੀ ਤੋਂ ਪਾਣੀ ਦੀ ਸਪਲਾਈ ਮਿਲਦੀ ਹੈ ਇਹ ਪਾਣੀ ਬਿਲਕੁਲ ਸਾਫ ਹੁੰਦਾ ਇਹ ਪਾਣੀ ਸਾਡੇ ਪੈਪਸੂ ਦੇ ਨਾ ਨਾਲ ਜਿਹੜੀਆਂ ਨਹਿਰਾਂ ਜੁੜੀਆਂ ਹੋਈਆ ਨੇ ਉਹਨਾਂ ਨਹਿਰਾਂ ਤੋਂ ਪਾਣੀ ਆਉਂਦਾ ਉਸ ਪਾਣੀ ਦੀ ਉਸ ਤੋਂ ਬਾਅਦ ਪਹਿਲਾਂ ਪਾਣੀ ਦੀ ਸਪਲਾਈ ਜਿਹਨੂੰ ਵਾਟਰ ਵਰਕਸ 'ਚ ਲੈ ਕੇ ਜਾਇਆ ਜਾਂਦਾ ਵਾਟਰਕਸ ਦੇ ਵਿੱਚ ਪਾਣੀ ਨੂੰ ਸਾਫ ਕੀਤਾ ਜਾਂਦਾ ਉਹਦੇ ਜਿਹੜੇ 'ਚ ਉਹਦੇ 'ਚ ਕਣ ਨੇ ਗੰਧਲੇ ਕਣ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਬਾਹਰ ਕੱਢਣ ਉਪਰੰਤ ਉਹਨਾਂ ਨੂੰ ਪੂਰੇ ਸ਼ਹਿਰ ਦੇ ਵਿੱਚ ਇੱਕ ਜਿਹੜੀ ਉਹ ਹੈਗੀ ਹੈ ਬਾਲਵ ਹੈ ਬਾਲਵ ਖੋਲ੍ਹ ਕੇ ਪੂਰੇ ਸ਼ਹਿਰ ਦੇ ਛੱਡਿਆ ਜਾਂਦਾ ਪਾਣੀ ਉਦੋਂ ਮਤਲਬ ਇਹ ਛੱਡਿਆ ਜਾਂਦਾ ਜਦੋਂ ਪਾਣੀ ਵਾ ਵਾਟਰ ਵਕਸ ਦੇ ਵਿੱਚ ਬਿਜਲੀ ਦੀ ਅਵੇਲੇਬਿਲਿਟੀ ਹੋਵੇ ਬਿਜਲੀ ਹੋਣ ਦੇ ਨਾਲ ਨਾਲ ਦੇ ਨਾਲ ਹੀ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਾਣੀ ਦੀ ਸਪਲਾਈ ਪੂਰੇ ਦੋ ਘੰਟੇ ਵਾਸਤੇ ਦਿੱਤੀ ਜਾਂਦੀ ਹੈ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਪਾਣੀ ਪੂਰੇ ਪਹਿਲੇ ਦਸ ਬਾਰ੍ਹਾਂ ਮਿੰਟ ਪਾਣੀ ਆਉਂਦਾ ਆਪਣੇ ਘਰਾਂ ਦੇ ਵਿੱਚੋਂ ਥੋੜ੍ਹਾ ਸਲੋ ਹੌਲੀ ਹੌਲੀ ਆਉਂਦਾ ਉਸ ਤੋਂ ਬਾਅਦ ਪੂਰਾ ਪੋਣਾ ਘ ਮਤਲਬ ਇੱਕ ਡੇਢ ਘੰਟੇ ਤੱਕ ਪੂਰਾ ਪਾਣੀ ਪੂਰੀ ਸਪੀਡ ਦੇ ਨਾਲ ਚੱਲਦਾ ਪਾਣੀ ਜਿਹੜਾ ਇਹ ਇਹ ਨਹਿਰਾਂ ਦਾ ਪਾਣੀ ਨਹਿਰਾਂ ਦਾ ਪਾਣੀ ਪੀਣ ਦੇ ਨਾਲ ਸਾਡੀ ਸਿਹਤ ਦੇ ਵਿੱਚ ਫਰਕ ਪੈਂਦਾ ਕਿਉਂਕਿ ਜਿਹੜਾ ਸਾਫ ਪਾਣੀ ਹੈ ਉਹਦੇ ਨਾਲ ਬਿਮਾਰੀਆਂ ਘੱਟ ਲੱਗਦੀਆਂ ਨੇ ਜੇ ਬਿਮਾਰੀਆਂ ਘੱਟ ਲੱਗਣਗੀਆਂ ਤਾਂ ਸਾਡਾ ਜੀਵਨ ਹੈ ਜਿਹੜਾ ਉਹ ਆਪਣੇ ਆਪਣੇ ਆਪ ਹੀ ਖੁਸ਼ਹਾਲ ਹੋਵੇਗਾ ਜੇ ਜੀਵਨ ਖੁਸ਼ਹਾਲ ਹੈ ਤਾਂ ਸਾਡੀ ਲੰਬੀ ਜ਼ਿੰਦਗੀ ਹੋਵੇਗੀ ਜੇ ਲੰਬੀ ਜ਼ਿੰਦਗੀ ਹੋਵੇ ਤਾਂ ਅਸੀਂ ਖੁਸ਼ਹਾਲ ਜੀਵਨ ਬਿਤਾਵਾਂਗੇ ਅਸੀਂ ਖੁਸ਼ੀ ਖੁਸ਼ੀ ਨਾਲ ਰਹਾਂਗੇ ਇੱਕ ਦੂਜੇ ਦੇ ਨਾਲ ਵੱਧ ਤੋਂ ਵੱਧ ਮਿਲਵਰਤਨ ਸਾਡਾ ਪੈਦਾ ਹੋਵੇਗਾ ਜਦੋਂ ਅਸੀਂ ਇੱਕ ਦੂਜੇ ਨਾਲ ਵੱਧ ਮਿਲਵਰਤਨ ਪੈਦਾ ਕਰਾਂਗੇ ਤਾਂ ਸਾਡੀਆਂ ਆਮ ਜ਼ਿੰਦਗੀ ਦੀਆਂ ਜਿਹੜੀਆਂ ਜਿਹੜੇ ਰੁਝੇਵੇਂ ਨੇ ਉਹ ਵਧਦੇ ਨੇ ਰੁਝੇਵੇਂ ਵਧਣ ਦੇ ਨਾਲ ਅਸੀਂ ਆਮ ਸ਼ਹਿਰਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਅਸੀਂ ਕੰਮ ਕਰਨ ਜਾਂਦੇ ਹਾਂ ਕੰਮ ਕਰਦੇ ਹਾਂ ਤਾਂ ਉੱਥੋਂ ਕਮਾਈ ਮਤਲਬ ਕਰਨੀ ਹੈ ਕਮਾਈ ਦੇ ਨਾਲ ਸਾਡਾ ਉਹ ਜੀਵਨ ਜਿਹੜਾ ਪਹਿਲਾਂ ਆਮ ਲੋਕਾਂ ਨੂੰ ਹੁੰਦਾ ਉਹ ਉਹਦੇ ਤੋਂ ਵੀ ਫਰਕ ਪੈਂਦਾ ਇਹਨੇ ਇਸ ਤਰ੍ਹਾਂ ਮਤਲਬ ਪਾਣੀ ਇੱਕ ਪਾਣੀ ਸਾਡੀ ਜਿ ਜ਼ਿੰਦਗੀ ਦਾ ਨਾ ਜਿਹੜਾ ਇਸ ਤਰਾਂ ਦਾ ਹਿੱਸਾ ਜੇ ਜਿਹੜਾ ਸਾਡੇ ਮਤਲਬ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਸਾਡੇ ਜੀਵਨ ਦੇ ਹਰੇਕ ਤਰ੍ਹਾਂ ਦੇ ਹਿੱਸੇ ਦੇ ਵਿੱਚ ਇਹ ਆਪਦਾ ਰੋਲ ਨਿਭਾਉਂਦਾ ਉਸ ਰੋਲ ਨਿਭਾਉਣ ਦੇ ਨਾਲ ਹੀ ਸਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਇਹਨਾਂ ਚੀਜ਼ਾਂ ਦੇ ਪਤਾ ਲੱਗਣ ਨਾਲ ਹੀ ਅਸੀਂ ਆਪਦੀ ਜ਼ਿੰਦਗੀ 'ਚ ਸੁਧਾਰ ਕਰ ਸਕਦੇ ਹਾਂ ਧੰਨਵਾਦ